ਮੇਰਾ ਮਨਪਸੰਦ ਅਖਬਾਰ ਅਜੀਤ ਅਖਬਾਰ ਹੈ ਅਤੇ ਮੈਂ ਡੇਲੀ ਉਹਨੂੰ ਪੜ੍ਹਦਾ ਹਾਂ ਡੇਲੀ ਮੇਰੇ ਘਰ ਆਉਂਦਾ ਹੈ ਡਾਕੀਆ ਅਖਬਾਰ ਵਾਲਾ ਦੇ ਕੇ ਜਾਂਦਾ ਮੇਰਾ ਮਨਪਸੰਦ ਰਸਾਲਾ ਵੀ ਆ ਅਤੇ ਮੈਂ ਫਰੂਟ ਬਲੋ ਫਰੂਟ ਫੂਡ ਬਲੋਗਿੰਗ ਦਾ ਬਹੁਤ ਜ਼ਿਆਦਾ ਸ਼ੌਕੀਨ ਹਾਂ ਅਤੇ ਅਜੀਤ ਅਖਬਾਰ ਹੋ ਗਿਆ ਜਗਬਾਣੀ ਅਖਬਾਰ ਹੋ ਗਿਆ ਇਹ ਮੈਂ ਅਖਬਾਰ ਬਹੁਤ ਜ਼ਿਆਦਾ ਪੜ੍ਹਦਾ ਰੀਡ ਕਰਦਾ ਅਤੇ ਇਹਨਾਂ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ